ਅਸੀਂ ਅੱਜ ਸਿੰਘ ਰਸੋਈ ਫਤਿਹਗੜ੍ਹ ਸਾਹਿਬ ਵਿਖੇ ਭੋਜਨ ਦਾ ਔਡਰ ਕੀਤਾ ਭੋਜਨ ਦੇ ਵਿੱਚ ਅਸੀਂ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਅਤੇ ਨਾਲ ਕੁਝ ਸਲਾਦ ਦੀਆਂ ਜੋ ਆਈਟਮਾਂ ਸ਼ਾਮਿਲ ਸਨ ਮੌਸਮ ਖਰਾਬ ਹੋਣ ਦੇ ਬਾਵਜੂਦ ਇਸ ਸਿੰਘ ਰਸੋਈ ਰੈਸਟੋਰੈਂਟ ਨੇ ਬੜੀ ਹੀ ਸ਼ਾਨਦਾਰ ਸੇਵਾਵਾਂ ਨਿਭਾਈਆਂ ਅਤੇ ਇਸ ਖਰਾਬ ਮੌਸਮ ਦੇ ਬਾਵਜੂਦ ਵੀ ਉਹਨਾਂ ਨੇ ਭੋਜਨ ਨੂੰ ਜਿਹੜਾ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਾਡੇ ਤੱਕ ਪਹੁੰਚਾਇਆ ਜਿਹਦੇ ਵਿੱਚ ਗਰਮ ਗਰਮ ਮੱਕੀ ਦੀਆਂ ਰੋਟੀਆਂ ਅਤੇ ਸਰ੍ਹੋਂ ਦਾ ਸਾਗ ਅਤੇ ਵਿੱਚ ਮੱਖਣ ਪਾਇਆ ਹੋਇਆ ਸੀ ਅਤੇ ਨਾਲ ਹੀ ਸਲਾਦ ਵੀ ਸੀ ਅਤੇ ਅਸੀਂ ਸਿੰਘ ਰਸੋਈ ਰੈਸਟੋਰੈਂਟ ਦਾ ਭੋਜਨ ਘਰ ਤੱਕ ਪਹੁੰਚਾਉਣ ਲਈ ਧੰਨਵਾਦ ਕਰਦੇ ਹਾਂ